ਭਾਰਤ ਵਿੱਚ ਪੜ੍ਹੇ ਲਿਖੇ ਲੋਕ ਬਹੁਤ ਜ਼ਿਆਦਾ ਹਨ ਅਤੇ ਪਰੈਟੀਕਲ ਜਾਣਕਾਰੀ ਬਹੁਤ ਘੱਟ ਹੁੰਦੀ ਹੈ ਬਾਹਰਲੇ ਦੇਸ਼ਾਂ ਵਿੱਚ ਪਰੈਟੀਕਲ ਜਾਣਕਾਰੀ ਜਾਂ ਪੜ੍ਹਾਈ ਦੇ ਨਾਲ ਪਰੈਟੀਕਲ ਜਾਣਕਾਰੀ ਬਹੁਤ ਜ਼ਿਆਦਾ ਦਿੰਦੇ ਹਨ ਕਿ ਜਿਹਦੇ ਕਰਕੇ ਬੱਚੇ ਦੂਜਾ ਕੰਮ ਵੀ ਕਰ ਸਕਣ ਆਪਣੇ ਭਾਰਤ ਵਿੱਚ ਇਹ ਚੀਜ਼ ਨਹੀਂ ਹੈ ਆਪਣੇ ਭਾਰਤੀਆਂ ਨੂੰ ਵੀ ਸਿੱਖਿਆ ਦੇਣੀ ਚਾਹੀਦੀ ਬੱਚਿਆਂ ਨੂੰ ਅਤੇ ਪਰੈਟੀਕਲ ਜਾਣਕਾਰੀ ਦਿੱਤੀ ਜਾਵੇ